ਹੈਲੋ ਹਾਂਜੀ ਹਾਂਜੀ ਵੀਰ ਜੀ ਉਰੇ ਉਰੇ ਵੀਰੇ ਆ ਜਿਓ ਸ਼੍ਰੀ ਫਤਿਹਗੜ੍ਹ ਸਾਹਿਬ ਹੈਗਾ ਹੈ ਅਤੇ ਤੁਹਾਨੂੰ ਆਪਾਂ ਲੈ ਕੇ ਜਾਵਾਂਗੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਆਮ ਖਾਸ ਬਾਗ ਹੈਗਾ ਵੀਰੇ ਉਸ ਤੋਂ ਬਾਅਦ ਰੋਜ਼ਾ ਸ਼ਰੀਫ ਹੈਗੀ ਆ ਰੋਜ਼ਾ ਸ਼ਰੀਫ ਤੋਂ ਬਾਅਦ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਹੈਗਾ ਜੀ ਅਤੇ ਤੁਹਾਨੂੰ ਆਪਾਂ ਜਹਾਜ਼ ਹਵੇਲੀ ਹੈਗੀ ਹੈ ਜੀ ਅਤੇ ਤੁਹਾਨੂੰ ਹੋਰ ਇੱਕ ਦੋ ਜਗ੍ਹਾ ਹੈਗੀਆਂ ਨੇ ਉਹ ਵੀ ਘੁੰਮਾ ਦਾਂਗੇ ਜੀ ਹਾਂਜੀ ਹਾਂਜੀ ਚਾਰਜ ਆਪਣਾ ਹੋਊਗਾ ਕਿੰਨੇ ਦਿਨ ਲਈ ਆਉਣਾ ਇੱਕ ਦਿਨ ਵਾਸਤੇ ਰਾਤ ਰਹੋਗੇ ਰਹਿਣ ਸਹਿਣ ਦਾ ਸਾਰਾ ਖਰਚਾ ਸਾਡਾ ਹੈ ਜੀ ਖਾਣ ਪੀਣ ਦਾ ਤੁਹਾਡਾ ਹੈ ਗੱਡੀ ਸਾਡੀ ਹੋਵੇਗੀ ਤੇਲ ਸਾਡਾ ਹੋਊ ਰੁਪਿਆ ਪੰਦਰਾਂ ਹਜ਼ਾਰ ਲੱਗੇਗਾ ਜੀ ਪੰਦਰਾਂ ਹਜ਼ਾਰ ਠੀਕ ਆ ਜੀ ਤੁਸੀਂ ਐਂ ਕਰਿਓ ਬਾਰ੍ਹਾਂ ਦੇ ਦਿਉ ਕੌਣ ਕੌਣ ਹੋ ਤੁਸੀਂ ਕਿੰਨੇ ਜਣੇ ਹੋ ਕਿੰਨੇ ਜਣੇ ਜੀ ਚਾਰ ਜਣੇ ਹੋਂ ਕੋਈ ਨਾ ਫਿਰ ਐਦਾਂ ਕਰਿਉ ਤੁਸੀਂ ਹੋਰ ਰੁਪਿਆ ਦਸ ਹਜ਼ਾਰ ਦੇ ਦਿਉ ਜੀ ਦਸ ਹਜ਼ਾਰ ਬਹੁਤ ਨਹੀਂ ਘੱਟ ਹੋਣਾ ਹੈਗਾ ਜੀ ਦਸ ਹਜ਼ਾਰ ਠੀਕ ਆ ਜੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਆਉ ਤਾਂ ਸਹੀ ਆਪਾਂ ਅੱਗੇ ਲੈ ਚੱਲਾਂਗੇ ਚਾਹੇ ਅੱਗੇ ਹੈਗੇ ਨੇ ਹੋਰ ਜੀ ਸਰਹਿੰਦ ਸਾਈਡ ਲੈ ਚੱਲਾਂਗੇ ਜੀ ਅੱਗੇ ਨਾ ਨਾ ਨਾ ਜੀ ਹਾਂਜੀ ਕੋਈ ਨਾ ਜੀ ਕੋਈ ਨਾ ਜੀ ਆ ਜਿਉ ਜੀ ਆ ਜਿਉ ਜੀ ਪਹੁੰਚਿਉ ਜੀ ਕਿੰਨੀ ਤਰੀਕ ਨੂੰ ਆਉਣਾ ਬਸ ਕੋਈ ਨਾ ਜੀ ਮੈਨੂੰ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰ ਦਿਉ ਮੈਂ ਸਾਰਾ ਕੁਛ ਕਰਕੇ ਤੁਹਾਨੂੰ ਰੈਡੀ ਕਰਕੇ ਦੇ ਦੂੰਗਾ